ਹੈਲੋ ਹਾਂਜੀ ਹਾਂਜੀ ਹਾਂਜੀ ਲੱਗ ਜਾਊ ਜੀ ਹਾਂਜੀ ਵਧੀਆ ਹੁੰਦੇ ਨੇ ਵਧੀਆ ਸਹੂਲਤ ਦਿੱਤੀ ਜਾਂਦੀ ਹੈ ਜੀ ਪੰਦਰਾਂ ਸੌ ਮਹੀਨਾ ਹੈ ਜੀ ਹਾਂਜੀ ਬੱਚੇ ਵੀ ਬਹੁਤ ਹੁੰਦੇ ਜਿੰਨਾ ਇਹ ਬ ਕੈਂਪ ਵੀ ਲਗਾਉਂਦੇ ਹਾਂ ਅਸੀਂ ਹਾਂਜੀ ਫ੍ਰੀ ਕੈਂਪ ਲਗਾਉਂਦੇ ਹਾਂ ਜੀ ਕਦੇ ਅਸੀਂ ਜੀ ਮਤਲਬ ਕਿ ਜਿਹੜੇ ਵੱਡੇ ਹੈ ਬ੍ਰਾਂਚ ਨੇ ਉੱਥੇ ਵੀ ਲਗਾਉਂਦੇ ਹਾਂ ਔਰ ਜਿਹੜੇ ਛੋਟੇ ਬੱਚੇ ਜਿਹੜੇ ਪਹਿਲਾਂ ਲੱਗਦੇ ਨੇ ਹਜੇ ਸ਼ੁਰੂ ਤੋਂ ਕੋਈ ਆਉਂਦਾ ਨਹੀਂ ਹੈਗਾ ਖੇਡਣਾ ਉਨ੍ਹਾਂ ਦੇ ਸਕੂਲਾਂ ਕੋਲਜਾਂ 'ਚ ਵੀ ਲਗਾਉਂਦੇ ਹਾਂ ਜੀ ਪਹਿਲਾਂ ਤੁਸੀਂ ਖੇਡਾਂ ਕੀਤੀਆਂ ਨੇ ਜੀ ਭਾਗ ਲਿਆ ਖੇਡਾਂ 'ਚ ਠੀਕ ਹੈ ਜੀ ਫਿਰ ਤਾਂ ਵਧੀਆ ਹੋਰ ਜੀ ਤੁਸੀਂ ਕਿਹੜੀਆਂ ਕਿਹੜੀਆਂ ਖੇਡਾਂ ਖੇਡੀਆਂ ਨੇ ਹਾਂਜੀ ਅੱਛਾ ਜੀ ਤਾਂ ਆ ਜਾਇਆ ਕਰੋ ਜੀ ਨੌਂ ਵਜੇ ਤੋਂ ਦੋ ਵਜੇ ਤੱਕ ਹਾਂਜੀ ਅਤੇ ਹੋਰ ਤੁਸੀਂ ਕਦੇ ਓ ਕੋਈ ਸਥਾਨ ਪ੍ਰਾਪਤ ਕੀਤਾ ਜੀ ਠੀਕ ਹੈ ਜੀ ਖੇਡਾਂ ਜੀ ਸਾਡੇ ਇੱਥੇ ਹੋਕੀ ਠੀਕ ਹੈ ਜੀ ਸਾਡੇ ਇੱਥੇ ਖੇਡਾਂ ਜੀ ਹੋਕੀ ਫੁੱਟਬਾਲ ਬਾਸਕਿਟਬਾਲ ਬੈਡਮਿੰਟਨ ਖੋ ਖੋ ਕਬੱਡੀ ਸਾਰਾ ਕੁਛ ਸਿਖਾਇਆ ਜਾਂਦਾ ਅਤੇ ਜੀ ਇਹਨਾਂ ਦਾ ਖੇਡਾਂ ਦਾ ਜਿਹੜਾ ਸਮਾਨ ਹੁੰਦਾ ਇਹਨਾਂ ਦਾ ਵੀ ਪ੍ਰਬੰਧ ਕੀਤਾ ਜਾਂਦਾ ਗਾ ਸਾਰਾ ਕੁਝ ਆਪਣੇ ਵੱਲੋਂ ਦਿੱਤਾ ਜਾਂਦਾ ਖਾਣ ਪੀਣ ਦਾ ਪ੍ਰਬੰਧ ਹੁੰਦਾ ਗਾ ਸਾਰਾ ਕੁਝ ਜਿਹੜਾ ਸਪੋਰਟਸ ਵਾਲਾ ਖਾਣ ਪੀਣ ਹੁੰਦਾ ਉਹ ਸਾਰਾ ਕੁਝ ਦਿੱਤਾ ਜਾ ਦਿੱਤਾ ਜਾਂਦਾ ਜੀ ਅਤੇ ਜੇ ਆਪਣੇ ਜਿਹੜੇ ਕੈਂਪ ਲੱਗਦੇ ਨੇ ਇਹਨਾਂ ਵਾਸਤੇ ਜਿਹੜੇ ਬੱਚੇ ਹੁੰਦੇ ਨੇ ਇਹਨਾਂ ਨੂੰ ਬਾਹਰ ਖੇਡਣ ਵਾਸਤੇ ਵੀ ਲਿਜਾਇਆ ਜਾਂਦਾ ਗਾ ਠੀਕ ਹੈ ਜੀ

ਬਹੁਤ ਵਧੀਆ ਜੀ ਕੋਚ ਬਾਹਰੋਂ ਆਉਂਦੇ ਨੇ ਗੇ ਬਹੁਤ ਵਧੀਆ ਸੁਭਾਅ ਉਹਨਾਂ ਦਾ ਸਾਰਿਆਂ ਦਾ ਸਾਰਿਆਂ ਨਾਲ ਵਧੀਆ ਮਿਲਕੇ ਬੋਲਦੇ ਹੈ ਵਧੀਆ ਮਿੱਠਾ ਸੁਭਾਅ ਗਾ ਉਹਨਾਂ ਦਾ ਜੀ ਹਾਂਜੀ ਅਤੇ ਮੈਡੀਕਲ ਸਹੂਲਤ ਵੀ ਦਿੱਤੀ ਜਾਂਦੀ ਹੈ ਜੀ ਜੇ ਕੋਈ ਵਿਦਿਆਰਥੀ ਜਾਂ ਖਿਡਾਰੀ ਜਖਮੀ ਹੋ ਜਾਂਦਾ ਗਾ ਉਹਨਾਂ ਨੂੰ ਮੈਡੀਕਲ ਸਹੂਲਤ ਵੀ ਦਿੱਤੀ ਜਾਂਦੀ ਹੈ ਜੀ ਹਾਈ ਲੈਵਲ ਤੱਕ ਖੇਡਾਂ ਕੀਤੀਆਂ ਜਾਂਦੀਆਂ ਨੇ ਜੀ ਅਤੇ ਓ ਜੇ ਕੋਈ ਜਿੱਤਦਾ ਗਾ ਤਾਂ ਉਹਨਾਂ ਨੂੰ ਹਾਈ ਲੈਵਲ ਤੱਕ ਲੈ ਕੇ ਵੀ ਜਾਇਆ ਜਾਂਦਾ ਹਾਂਜੀ ਕੋਈ ਨਾ ਜੀ ਤੁਸੀਂ ਆ ਜਾਇਆ ਕਰੋ ਅਤੇ ਉਹਦੇ ਹਿਸਾਬ ਨਾਲ ਅਸੀਂ ਦੇਖਲਾਂਗੇ ਵੀ ਤੁਹਾਨੂੰ ਕਿਹੜੀ ਖੇਡ ਦੇਣੀ ਆ ਤਾਂ ਵਧੀਆ ਰੁਟੀਨ 'ਚ ਆਇਆ ਕਰੋ ਤੁਸੀਂ ਹਾਂਜੀ ਸਾਡੀਆਂ ਬ੍ਰਾਂਚਾਂ ਵੀ ਨੇ ਸੰਗਰੂਰ ਪਟਿਆਲੇ ਉੱਥੋਂ ਦੇ ਕੋਚ ਅਉਂਦੇ ਨੇ ਵਧੀਆ ਵਧੀਆ ਸਿਖਾਉਂਦੇ ਨੇ ਜੀ ਹਾਂਜੀ ਆ ਜਾਇਆ ਕਰੋ ਜੀ ਚਾਹੇ ਰੋਜ਼ ਸੁਬਾਹ ਤੋਂ ਸ਼ੁਰੂ ਕਰ ਦਿਓ ਜੀ ਠੀਕ ਹੈ ਜੀ ਧੰਨਵਾਦ